ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਪਠਾਨਕੋਟ ਤੋਂ ਹਰਜੀਤ ਕੌਰ ਬੋਲ ਰਹੀ ਹਾਂ ਹਾਂਜੀ ਮਤਲਬ ਕਿ ਸਾਡੇ ਟਾਈਮ ਦਾ ਅਤੇ ਹੁਣ ਦੇ ਟਾਈਮ ਦਾ ਤਾਂ ਬਹੁਤ ਫਰਕ ਆ ਹੁਣ ਤਾਂ ਬੱਚੇ ਸਾਰਾ ਦਿਨ ਮੋਬਾਈਲ 'ਤੇ ਹੀ ਲੱਗੇ ਰਹਿੰਦੇ ਹਨ ਅਤੇ ਮੋਬਾਇਲ 'ਤੇ ਹੀ ਗੇਮਾਂ ਖੇਡਦੇ ਹਨ ਪਰ ਸਾਡੇ ਟਾਈਮ 'ਚ ਇਸ ਤਰ੍ਹਾਂ ਨਹੀਂ ਸੀ ਹੁੰਦਾ ਸਾਡੇ ਟਾਈਮ ਦੇ ਉੱਤੇ ਬੱਚੇ ਖੋ ਖੋ ਖੇਡਦੇ ਸੀ ਬੁਲਬੁਲ ਖੇਡਦੇ ਸੀ ਸਟਾਪੂ ਖੇਡਦੇ ਸੀ ਕਾਫੀ ਮਤਲਬ ਕਿ ਤਰ੍ਹਾਂ ਦੀਆਂ ਖੇਡਾਂ ਖੇਡਦੇ ਸਨ ਜਿੱਦਾਂ ਜਿਸ ਤਰ੍ਹਾਂ ਕਿ ਬਾਂਦਰ ਕਿੱਲਾ ਇਸ ਤਰ੍ਹਾਂ ਦੀਆਂ ਕਾਫੀ ਗੇਮਾਂ ਹੁੰਦੀਆਂ ਸੀ ਅਤੇ ਉਹਨਾਂ ਦੇ ਨਾਲ ਸਰੀਰ ਦੀ ਵੀ ਸਰੀਰ ਦੇ ਵਿੱਚ ਵੀ ਐਕਟੀਵਿਟੀ ਬਣੀ ਰਹਿੰਦੀ ਸੀ ਪਰ ਅੱਜ ਕੱਲ੍ਹ ਦਾ ਸਮਾਂ ਕੁਛ ਹੋਰ ਹਿਸਾਬ ਦਾ ਹੈ ਇਹਨਾਂ ਵਿੱਚੋਂ ਜਿਸ ਤਰ੍ਹਾਂ ਅਸੀਂ ਬੁਲਬੁਲ ਖੇਡਦੇ ਸੀ ਉਹਨਾਂ ਦੇ ਵਿੱਚ ਸਾਰੇ ਗੋਲ ਧਾਰਾ ਬਣਾ ਲੈਂਦੇ ਸੀ ਅਤੇ ਗੋਲ ਧਾਰਾ ਬਣਾ ਕੇ ਇੱਕ ਦੂਸਰੇ ਦੇ ਉੱਤੇ ਕੱਪੜਾ ਸੁੱਟ ਦਿੰਦੇ ਸੀ ਜਿਸ ਤਰ੍ਹਾਂ ਸਟਾਪੂ ਖੇਡਦੇ ਸੀ ਉਹ ਅਸੀਂ ਸਟਾਪੂ ਦਾ ਚੌਰਸ ਬਣਾ ਕੇ ਉਹਦੇ ਵਿੱਚ ਅਸੀਂ ਡੱਬੇ ਬਣਾ ਲੈਂਦੇ ਸੀ ਅਤੇ ਇੱਕ ਠਿੱਕਰੀ ਲੈ ਕੇ ਅਤੇ ਉਹਦੇ ਨਾਲ ਸਟਾਪੂ ਖੇਡਦੇ ਸੀ ਅਤੇ ਉਸ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਖੋ ਖੋ ਖੇਡਦੇ ਸੀ ਉਸ ਉਹ ਵੀ ਇੱਕ ਲੰਬੀ ਲਾਈਨ ਬਣਾ ਕੇ ਅਤੇ ਜਿਸ ਦੇ ਉੱਤੇ ਕੱਪੜਾ ਗ ਖੇਡਦੇ ਸੀ ਉਸਦੀ ਵਾਰੀ ਆ ਜਾਂਦੀ ਸੀ ਇਸ ਤਰ੍ਹਾਂ ਦੀ ਅਸੀਂ ਗੇਮਾਂ ਖੇਡਦੇ ਸੀ ਅਤੇ ਹੁਣ ਮਤਲਬ ਕਿ ਕਾਫੀ ਸਮਾਂ ਠੀਕ ਸੀ